ਹਾਂਜੀ ਰੂਪਨਗਰ ਜ਼ਿਲ੍ਹੇ ਵਿੱਚ ਰਿਹਾਇਸ਼ੀ ਬਹੁਤ ਸਾਰੇ ਹਨ ਜਿਵੇਂ ਕਿ ਕਈ ਲੋਕ ਉਹਨਾਂ ਨੂੰ ਵੀ ਬਾਹਰ ਤੋਂ ਸਟੂਡੈਂਟਸ ਜਿਹੜੇ ਪੜ੍ਹੇ ਆ ਪੜ੍ਹਨ ਆਉਂਦੇ ਹਨ ਉਹਨਾਂ ਵਾਸਤੇ ਪੀ ਜੀ ਦਿੰਦੇ ਹਨ ਅਤੇ ਕਈ ਤਾਂ ਜਿਵੇਂ ਕਈ ਜਿਵੇਂ ਜਿ ਔਨਰ ਨਾਲ਼ ਰਹਿ ਰਿਹਾ ਹੈ ਅਤੇ ਉੱਥੇ ਤਾਂ ਕਿਆ ਕਹਿੰਦੇ ਹੈ ਔਰ ਕਿਰਾਇਆ ਘੱਟ ਰੱਖਿਆ ਹੁੰਦਾ ਹੈ ਜਿਹੜੇ ਰਿਅਲ ਸਟੇਟ ਦੇ ਵਿੱਚ ਨਾਲ਼ ਅੰਬਾਨੀਆਂ ਦਾ ਵੀ ਜਿਵੇਂ ਸਿਰਫ ਬੰਦਿਆਂ ਨੇ ਫਲੈਟਸ ਏ ਬਣਾਏ ਹੋਏ ਬਿਲਡਿੰਗਸ ਬਣਾਈਆਂ ਹੋਈਆਂ ਹੈ ਉਹਦੇ ਵਿੱਚ ਜੋ ਹੈ ਰੈਂਟ ਜ਼ਿਆਦਾ ਰੱਖਿਆ ਜਾਂਦਾ ਹੈ ਅਤੇ ਵ ਜਿਵੇਂ ਕਿ ਉਸ ਤਰੀਕੇ ਨਾਲ਼ ਬੰਦਾ ਓ ਉਹ ਕਰ ਸਕਦਾ ਹੈ ਵਿੱਚ ਉਹਨਾਂ ਨੂੰ ਪ ਪੂਰੀ ਪਾਰਟੀਸ਼ਨ ਵਗੈਰਾ ਮਿਲਦੀ ਹੈ ਜਿਵੇਂ ਕਿ ਸਾਰਾ ਸਮਾਨ ਜੋ ਵੀ ਕਮਰੇ ਦਾ ਉਹਨਾਂ ਨੂੰ ਚਾਹੀਦਾ ਹੈ ਸਾਰਾ ਵਿੱਚ ਉਹਨਾਂ ਨੂੰ ਮਿਲ ਜਾਂਦਾ ਹੈ